ਕਾਰੋਬਾਰ ਸ਼ੁਰੂ ਕਰਦੇ ਸਮੇਂ ਪਰ ਲੋਕਾਂ ਨੂੰ ਛੋਟੇ ਕਾਰੋਬਾਰ ਨੂੰ ਖੋਲ੍ਹਣਾ ਜਿੰਨਾ ਆਸਾਨ ਲੱਗਦਾ ਹੈ ਪਰ ਅਸਲ ਵਿੱਚ ਖੋਲ੍ਹਣ ਕੋਈ ਸੌਖਾ ਕਦ ਉੱਦਮ ਨਹੀਂ ਇਸ ਬਾਰੇ ਤੁਹਾਨੂੰ ਬਹੁਤ ਖੋਜ ਕਰਨੀ ਪਵੇਗੀ ਕਿ ਮਾਰਕੀਟ ਕਿਵੇਂ ਕੰਮ ਕਰਦਾ ਹੈ ਇਸ ਕਾਰੋਬਾਰ ਵਿੱਚ ਮੰਗ ਅਤੇ ਸਪਲਾਈ ਦੀ ਚੇਨ ਕੀ ਹੈ ਕਾਰੋਬਾਰ ਲਈ ਤੁਹਾਡੇ ਰੋਜ਼ਾਨਾ ਸਟਾਈਲਿੰਗ ਅਤੇ ਪੇਸ਼ਕਾਰੀ ਦੀ ਸਮਝ ਅਤੇ ਲੋੜ ਹੁੰਦੀ ਹੈ ਤੁਹਾਡੇ ਕੋਲ ਇੱਕ ਵਧੀਆ ਦੁਕਾਨਦਾਰ ਦੇ ਹੁਨਰ ਅਤੇ ਇੱਕ ਹਮਦਰਦੀ ਵਾਲੀ ਸ਼ਖਸ਼ੀਅਤ ਹੋਣ ਦੀ ਜ਼ਰੂਰਤ ਹੈ ਤੁਹਾਨੂੰ ਜ਼ਰੂਰਤ ਪਤਾ ਹੋਣਾ ਚਾਹੀਦਾ ਹੈ ਕਿ ਗਾਹਕਾਂ ਨੂੰ ਆਪਣੀ ਦੁਕਾਨ ਵੱਲ ਕਿਵੇਂ ਆਕਰਸ਼ਿਤ ਕਰਨਾ ਹੈ ਤੋ ਇਸ ਤੋਂ ਬਾਅਦ ਛੋਟਾ ਜਾਂ ਵੱਡਾ ਕੋਈ ਕਾਰੋਬਾਰ ਸਥਾਪਿਤ ਕਰਨ ਲਈ ਬਹੁਤ ਹੌਸਲੇ ਦੀ ਲੋੜ ਹੁੰਦੀ ਹੈ ਪੈਂਦੀ ਹੈ ਸਾਡੇ ਦੇਸ਼ ਦੀ ਆਰਥਿਕਤਾ ਦੀ ਮੌਜੂਦਾ ਸਥਿਤੀ ਅਤੇ ਬੇਰੁਜ਼ਗਾਰੀ ਦਰ ਨਾਲ ਆਪਣੀ ਮਰਜ਼ੀ ਨਾਲ ਸਾਨੂੰ ਇਸ ਬਹਾਦਰੀ ਨੂੰ ਦਰਸਾਉਣਾ ਅਤੇ ਕਾਰੋਬਾਰ ਦੇ ਉਦਯੋਗਾਂ ਅਤੇ ਵਿਸ਼ਾਲ ਸਮੁੰਦਰ ਵਿੱਚ ਆਪਣੇ ਪੈਰ ਫਸਾਉਣ ਦੀ ਜ਼ਰੂਰਤ ਹੈ